ਹਾਂਜੀ ਅਸੀਂ ਨਾ ਜੀ ਜੱਗ ਬਾਣੀ ਅਖ਼ਬਾਰ ਦੇ ਪੱਤਰਕਾਰ ਬੋਲਦੇ ਸੀ ਜੀ ਅਸੀਂ ਨਾ ਤੁਹਾਡੇ ਤੋਂ ਕੁਛ ਨੋਲੇਜ ਲੈਣੇ ਸੀਗੀ ਜੀ ਵੀ ਜਿਹੜਾ ਗੁਰ ਗੋਬਿੰਦ ਸਿੰਘ ਜੀ ਦਾ ਜਿਹੜਾ ਇੱਥੇ ਦੀ ਇਤਿਹਾਸ ਕੀ ਹੈ ਜੀ ਮੁਕਤਸਰ ਸ਼ਹਿਰ ਦਾ ਉਹਦੇ ਬਾਰੇ ਅਸੀਂ ਕੋਲਮ ਲਿੱਖਣਾ ਸੀਗਾ ਅਤੇ ਉਹ ਸਾਨੂੰ ਉਸ ਬਾਰੇ ਥੋੜ੍ਹੀ ਜਾਣਕਾਰੀ ਦੱਸੋਗੇ ਜੀ ਹਾਂਜੀ ਉਹ ਬਸ ਅਸੀਂ ਇਹ ਹੀ ਪੁੱਛਣਾ ਇੱਧਰੋਂ ਦੱਸੋ ਤੁਸੀਂ ਕਿਵੇਂ ਇਹਨਾਂ ਦਾ ਕੀ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਅਤੇ ਕਿਵੇਂ ਚਾਲ੍ਹੀ ਮੁਕਤਿਆਂ ਦਾ ਇਤਿਹਾਸ ਇਹ ਸਾਰੇ ਬਾਰੇ ਦੱਸ ਦਓ ਸਾਨੂੰ ਟੁੱਟੀ ਗੰਡੀ ਸਾਹਿਬ ਜਿਵੇਂ ਸਾਰੇ ਗੁਰਦੁਆਰਾ ਸਾਹਿਬ ਜਾਂ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਆ ਉਵੇਂ ਸਾਨੂੰ ਕੋਲਮ ਦੱਸੋ ਅਸੀਂ ਉਹ ਲਿਖਣਾ ਹੈ ਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ

ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਖੂਹ ਸਰ ਗੁਰਦੁਆਰਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਿਆ ਜੀ ਅਤੇ ਹੋਰ ਇਤਿਹਾਸ ਕੋਈ ਹੋਰ ਕੋਈ ਜਾਣਕਾਰੀ